ਤੁਹਾਡਾ ਬਹੁਤ ਹੀ ਸ਼ੁਕਰੀਆ ਭਾਈ ਸਾਹਿਬ ਤੁਸੀਂ ਮੈਨੂੰ ਇਸ ਰਾਤ ਦੇ ਟਾਈਮ 'ਤੇ ਬੜੇ ਹੀ ਸੁਰੱਖਿਅਤ ਤਰੀਕੇ ਨਾਲ ਘਰ ਵਿੱਚ ਛੱਡਿਆ ਕਿਉਂਕਿ ਇਸ ਰਾਤ ਦੇ ਟਾਈਮ 'ਤੇ ਅਸੀਂ ਕਿਸੇ ਅਣਜਾਣ ਵਿਅਕਤੀ 'ਤੇ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ ਕਿ ਉਹ ਸਾਨੂੰ ਸਹੀ ਰਸਤੇ ਲੈ ਕੇ ਜਾ ਰਿਹਾ ਹੈ ਕਿ ਨਹੀਂ ਜਾ ਰਿਹਾ ਇਸ ਕਰਕੇ ਤੁਸੀਂ ਮੈਨੂੰ ਬੜੇ ਹੀ ਸੁਰੱਖਿਅਤ ਤਰੀਕੇ ਨਾਲ ਮੇਰੇ ਘਰ ਪਹੁੰਚਾ ਦਿੱਤਾ ਅਤੇ ਰਾਤ ਤੱਕ ਮੈਂ ਤੁਹਾਡਾ ਬਹੁਤ ਹੀ ਆਭਾਰੀ ਹਾਂ ਅਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਮੈਨੂੰ ਮੇਰੇ ਘਰ ਤੱਕ ਇੰਨੀ ਰਾਤ ਨੂੰ ਸੁਰੱਖਿਅਤ ਢੰਗ ਨਾਲ ਪਹੁੰਚਾ ਦਿੱਤਾ ਹੈ ਧੰਨਵਾਦ ਭਾਈ ਸਾਹਿਬ